ਇੱਕ ਨਵੰਬਰ ਉੱਨੀ ਸੌ ਛਿਆਸੀ ਸਤਾਰਾਂ ਦਸੰਬਰ ਦੋ ਹਜ਼ਾਰ ਸਤਾਰਾਂ ਬਾਰਾਂ ਜਨਵਰੀ ਉੱਨੀ ਸੌ ਪਚਾਨਵੇਂ ਪੰਦਰਾਂ ਫਰਵਰੀ ਉੱਨੀ ਸੌ ਸਤਾਸੀ ਸੱਤ ਸਤੰਬਰ ਉੱਨੀ ਸੌ ਨੜ੍ਹਿਨਵੇਂ